ਸਤਿ ਸ਼੍ਰੀ ਅਕਾਲ ਸਰ ਮੈਂ ਦੇਸ ਰਾਜ ਬੋਲਦਾ ਹਾਂ ਪਠਾਨਕੋਟ ਤੋਂ ਸਾਡੇ ਪੰਜਾਬ ਵਿੱਚ ਪੱਗ ਬਹੁਤ ਹੀ ਜ਼ਰੂਰੀ

ਇਹ ਪੱਗ ਮੌਕੇ ਅਨੁਸਾਰ ਉਦੋਂ ਹੀ ਬੰਨ੍ਹੀ ਜਾਂਦੀ ਹੈ ਜਦੋਂ ਮੁੰਡਾ ਵਿਆਹ ਸ਼ਾਦੀ ਦੇ ਵਿੱਚ ਕੀਤਾ ਜਾਂਦਾ ਵਿਆਹ ਸ਼ਾਦੀ ਕੀਤਾ ਜਾਂਦਾ ਹੈ ਪੱਗ ਉਦੋਂ ਮੁੰਡੇ ਦੇ ਮੁੰਡੇ ਦੇ ਮੁੰਡੇ ਦੇ ਭਰਾ ਚਾਚੇ ਤਾਏ ਪੱਗਾਂ ਦੇ ਨਾਲ ਬਹੁਤ ਹੀ ਸੱਜ ਵੱਜ ਕੇ ਪੱਗਾਂ ਬੰਨ੍ਹਦੇ ਨੇ ਜਦੋਂ ਪੱਗ ਸਿਰ 'ਤੇ ਬੰਨ੍ਹਦੇ ਨੇ ਸਭ ਤੋਂ ਪਹਿਲਾਂ ਪੱਗ ਸਿਰ ਦੇ ਉੱਤੇ ਫਿਫਟੀ ਬੰਨ੍ਹੀ ਜਾਂਦੀ ਹੈ ਪੱਗ ਬੜੇ ਲੜ ਕੱਢ ਕੇ ਬੰਨ੍ਹੀ ਜਾਂਦੀ ਹੈ ਇਸ ਕਰਕੇ ਇਹ ਜਿਹੜੀ ਪੱਗ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਮਸ਼ਹੂਰ ਹੈ ਇਹ ਪੱਗ ਬੰਨ੍ਹ ਸਾਡੇ ਪੰਜਾਬ ਦੀ ਬਹੁਤ ਹੀ ਬਹੁਤ ਹੀ ਜ਼ਰੂਰੀ ਹੈ ਪੱਗ ਮੌਕੇ ਅਨੁਸਾਰ ਉਦੋਂ ਹੀ ਬੰਨ੍ਹੀ ਜਾਂਦੀ ਹੈ ਜਦੋਂ ਮੁੰਡਾ ਵਿਆਹ ਦੇ ਵਿੱਚ ਰੁੱਝਿਆ ਜਾਂਦਾ ਹੈ